ਸਤਿ ਸ਼੍ਰੀ ਅਕਾਲ ਜੀ ਤੁਸੀਂ ਸਵੀਗੀ ਤੋਂ ਬੋਲ ਰਹੇ ਹੋ ਮੈਂ ਨੀਤੀਕਾ ਸ਼ਰਮਾ ਅਸੀਂ ਇੱਕ ਘੰਟਾ ਪਹਿਲਾਂ ਤੁਹਾਡੇ ਰੈਸਟੋਰੇਂਟ 'ਚ ਓਡਰ ਪਾਇਆ ਸੀ ਕੜਾਹੀ ਪਨੀਰ ਦਾ ਅਤੇ ਪਹਿਲੀ ਗੱਲ ਸਾਡੇ ਘਰ ਗੈਸਟ ਆਏ ਸੀ ਅਸੀਂ ਸਬਜ਼ੀ ਮੰਗਵਾਈ ਸੀ ਤੁਹਾਡੇ ਤੋਂ ਅਤੇ ਤੁਸੀਂ ਪਹਿਲੀ ਗੱਲ ਤਾਂ ਉਹ ਲੇਟ ਭੇਜੀ ਹੈ ਅਤੇ ਦੂਜੀ ਗੱਲ ਤੁਸੀਂ ਕੜਾਹੀ ਪਨੀਰ ਦੀ ਜਗ੍ਹਾ ਅਤੇ ਚਿਕਨ ਟਿੱਕਾ ਭੇਜ ਤਾ ਅਤੇ ਇਹ ਸਹੀ ਗੱਲ ਨਹੀਂ ਸੀ ਸਾਡੇ ਜਿਹੜੇ ਘਰ 'ਚ ਓ ਭੇਜਣਾ ਨਹੀਂ ਚਾਹੀਦਾ ਸੀ ਹੀਨੂੰ ਇਹ ਗਲਤ ਆ ਤੁਹਾਡੀ ਗੱਲ ਸਾਡਾ ਧਰਮ ਵੀ ਭਰਸ਼ਟ ਹੋਇਆ ਇਹਦੇ ਨਾਲ ਕ੍ਰਿਪਾ ਕਰਕੇ ਜਾਂ ਤਾਂ ਹੁਣ ਤੁਸੀਂ ਆਓ ਅਤੇ ਆਪਣਾ ਚਿਕਨ ਟਿੱਕਾ ਲੈ ਕੇ ਜਾਓ ਅਤੇ ਸਾਡੇ ਪੈਸੇ ਵਾਪਿਸ ਕਰੋ ਅਤੇ ਆਪਣੀਆਂ ਗਲਤੀਆਂ ਸੁਧਾਰੋ ਵੀ ਅਸੀਂ ਤੁਹਾਡੇ ਤੋਂ ਕੀ ਮੰਗਵਾ ਰਹੇ ਹਾਂ ਕੀ ਕਰ ਰਹੇ ਹਾਂ ਅਤੇ ਤੁਸੀਂ ਦੇਖੋ ਤੁਸੀਂ ਸਾਨੂੰ ਟਾਇਮ ਪਾਇਆ ਸੀ ਅੱਧੇ ਘੰਟੇ ਵਿੱਚ ਓਡਰ ਆਊਗਾ ਤਾਂ ਆਇਆ ਕ ਓਡਰ ਲੇਟ ਘੰਟੇ ਬਾਅਦ ਅਤੇ ਉੱਤੋਂ ਓਡਰ ਵੀ ਆਇਆ ਤੁਹਾਡਾ ਗਲਤ ਸਾਨੂੰ ਪਲੀਸ ਆਪਣਾ ਇਹ ਜਿਹੜਾ ਓਡਰ ਹੈ ਵਾਪ ਲੈ ਕੇ ਜਾਓ ਅਤੇ ਸਾਡੇ ਪੈਸੇ ਹੈ ਜਿਹੜੇ ਸਾਨੂੰ ਵਾਪਸ ਕਰਕੇ ਜਾਓ ਮੈਂ ਬਠਿੰਡੇ ਤੋਂ ਹਾਂ ਮੇਰਾ ਘਰ ਕੋਲ ਤੁਹਾਡਾ ਕੋਲ ਮੇਰਾ ਘਰ ਦਾ ਐਡਰੈਸ ਹੈਗਾ ਤੁਸੀਂ ਆਪਣੇ ਐਡ ਮੇਰੇ ਐਡਰੈਸ 'ਤੇ ਆਓ ਅਤੇ ਆਪਣੇ ਪੈਸੇ ਮੇਰੇ ਪੈਸੇ ਦੇ ਜਾਓ ਅਤੇ ਆਪਣਾ ਓਡਰ ਲੈ ਜਾਓ